ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਫਾਜਿਲਕਾ ਤੋਂ ਬਹੁਤ ਗੱਡੀਆਂ ਜਾਂਦੀਆਂ ਨੇ ਰਵਾੜੀ ਵਾਲੀ ਵੀ ਜਾਂਦੀ ਹੈ ਚੰਡੀਗੜ੍ਹ ਵੀ ਜਾਂਦੀ ਹੈ ਅਬੋਰ ਵੀ ਜਾਂਦੀ ਹੈ ਗੰਗਾ ਨਗਰ ਵਾਲੀ ਵੀ ਜਾਂਦੀ ਆ ਅਤੇ ਹੋਰ ਵੀ ਵਾਧੂ ਜਾਂਦੀਆਂ ਨੇ ਫਿਰੋਜ਼ਪੁਰ ਵੱਲ ਵੀ ਜਾਂਦੀ ਹੈ ਹਰ ਰੂਟ 'ਤੇ ਗੱਡੀਆਂ ਤੁਸੀਂ ਕਿੱਥੇ ਜਾਣਾ ਤੁਸੀਂ ਇਹ ਦੱਸੋ ਅਤੇ ਤੁਸੀਂ ਜਾਣਾ ਕਿਹੜੇ ਸ਼ਹਿਰ ਹੈ ਤੁਸੀਂ ਉਹ ਦੱਸੋ ਨਹੀਂ ਨਹੀਂ ਹਾਂਜੀ ਉਹ ਤਾਂ ਅਸੀਂ ਦੱਸ ਸਕਦੇ ਹਾਂ ਪਰ ਤੁਸੀਂ ਪਰਟੀਕੁਲਰ ਸ਼ਹਿਰ ਦਾ ਦੱਸੋ ਤੁਸੀਂ ਕਿੱਥੇ ਜਾਣਾ ਹੈ ਕਿਹੜੀ ਟਰੇਨ ਦਾ ਟਾਈਮ ਤੁਸੀਂ ਪੁੱਛਣਾ ਹਾਂਜੀ ਹਾਂਜੀ ਜਿਹੜੀ ਹਰਿਦੁਆਰ ਵਾਲੀ ਆ ਉਹ ਰਾਤੀ ਦੋ ਵਜੇ ਜਾਂਦੀ ਹੈ ਟ੍ਰੇਨ ਆ ਹਾਂਜੀ ਅਤੇ ਗੰਗਾ ਨਗਰ ਵਾਲੀ ਸਵੇਰੇ ਸਾਢੇ ਸੱਤ ਵਜੇ ਜਾਂਦੀ ਆ ਹਾਂਜੀ ਤੁਸੀਂ ਆਰਾਮ ਨਾਲ ਆਪਣੀ ਯਾਤਰਾ ਕਰ ਸਕਦੇ ਹੋ ਤੁਸੀਂ ਜਾ ਸਕਦੇ ਹੋ ਅਤੇ ਕੋਈ ਦਿੱਕਤ ਨਹੀਂ ਆਉਣੀ ਫਿਰੋਜ਼ਪੁਰ ਵਾਲੀ ਸਵੇਰੇ ਛੇ ਵਜੇ ਜਾਂਦੀ ਆ ਹਾਂਜੀ ਉਹ ਅੱਠ ਵਜੇ ਜਾਂਦੀ ਹੈ ਤੁਸੀਂ ਜਾਣਾ ਕਿੱਥੇ ਆ ਵੈਸੇ ਹਾਂਜੀ ਤਾਂ ਤੁਸੀਂ ਫਾਜ਼ਿਲਕਾ ਤੋਂ ਪੁੱਛ ਰਹੇ ਹੋ ਨਾ ਤਾਂ ਫਾਜ਼ਿਲਕਾ ਤੋਂ ਹਰਿਦਵਾਰ ਨੂੰ ਦੋ ਵਜੇ ਹੀ ਜਾਂਦੀ ਹੈ ਟ੍ਰੇਨ ਤੁਸੀਂ ਉਹਦੇ 'ਤੇ ਜਾ ਸਕਦੇ ਹੋ ਹਾਂਜੀ ਨਹੀਂ ਨਹੀਂ ਫਾਜ਼ਿਲਕਾ ਤੋਂ ਤਾਂ ਜਿਹੜੀ ਹਰਿਦੁਆਰ ਤੁਸੀਂ ਜਾਣਾ ਤਾਂ ਦੋ ਵਜੇ ਜਾਂਦੀ ਹੈ ਅਤੇ ਗੰਗਾ ਨਗਰ ਜਾਣਾ ਸਵੇਰੇ ਸਾਡੇ ਸੱਤ ਜਾਂਦੀ ਆ ਬਾਕੀ ਤੁਸੀਂ ਆਪਦੀ ਸਹੂਲਤ ਦੇ ਹਿਸਾਬ ਨਾਲ ਤੁਸੀਂ ਵੇਖ ਲਿਓ ਜੇ ਕਿਤੇ ਕਿਤੇ ਜਾਣਾ ਤੁਸੀਂ ਠੀਕ ਹੈ